ਸਤਿ ਸ਼੍ਰੀ ਅਕਾਲ ਜੀ ਜਿਵੇਂ ਹੈ ਨਾ ਆਪਾਂ ਅਕਸਰ ਸੁਣਦੇ ਹਾਂ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੁੰਦੀਆਂ ਨਾ ਵਧੀਆ ਗੱਲ ਹੈ ਕਿਤਾਬਾਂ ਮਨੁੱਖ ਨੂੰ ਇੱਕ ਵਧੀਆ ਸੇਧ ਦਿੰਦੀਆਂ ਨੇ ਪਰ ਨਾ ਕਈ ਕਿਤਾਬਾਂ ਮੈਂ ਕਿਸੇ ਕਿਤਾਬ ਦਾ ਨਾਮ ਨਹੀਂ ਲੈਣਾ ਚਾਹੁੰਦੀ ਕਈ ਕਿਤਾਬਾਂ ਨਾ ਜਿਹੜੀਆਂ ਮੈਂ ਪੜ੍ਹੀਆਂ ਨੇ ਕਾਫੀ ਪੜ੍ਹੀਆਂ ਵੈਸੇ ਕਈ ਕਿਤਾਬਾਂ ਇਹੋ ਜਿਹੀਆਂ ਨੇ ਜਿਹੜੀਆਂ ਨਾ ਤੁਹਾਡੇ ਮਨ ਨੂੰ ਨਮੋਸ਼ੀ ਪੈਦਾ ਕਰ ਦਿੰਦੀਆਂ ਨੇ ਮਨ 'ਚ ਹੈ ਨਾ ਮਤਲਬ ਉਹਨਾਂ ਦਾ ਕੋਈ ਲੈਵਲ ਨਹੀਂ ਹੁੰਦਾ ਕੋਈ ਮਿਆਰ ਨਹੀਂ ਹੁੰਦਾ ਕੋਈ ਮਤਲਬ ਉਹਨਾਂ ਦਾ ਸਿਰ ਪੈਰ ਨਹੀਂ ਬਣਦਾ ਕੋਈ ਕਵਿਤਾਵਾਂ ਦੀਆਂ ਕਿਤਾਬਾਂ ਕਹਿ ਲਓ ਨਾ ਤਾਂ ਉਹ ਕਵਿਤਾਵਾਂ ਹੁੰਦੀਆਂ ਨੇ ਨਾ ਖੁੱਲ੍ਹੀ ਕਵਿਤਾ ਹੁੰਦੀ ਹੈ ਨਾ ਕੋਈ ਗਜ਼ਲ ਹੁੰਦੀ ਏ ਇਸੇ ਤਰ੍ਹਾਂ ਹੀ ਕੋਈ ਕਹਾਣੀ ਲਾ ਲਓ ਜਾਂ ਵਾਰਤਕ ਦੀਆਂ ਕਿਤਾਬਾਂ ਮੈਂ ਕਈ ਪੜ੍ਹੀਆਂ ਨੇ ਉਹਨਾਂ ਦਾ ਕੋਈ ਇੱਦਾਂ ਕੋਈ ਨਾ ਤਾਂ ਉਹਨਾਂ ਦਾ ਕੋਈ ਅੰਤ ਹੁੰਦਾ ਨਾ ਕੋਈ ਸ਼ੁਰੂਆਤ ਹੁੰਦੀ ਹੈ ਨਾ ਕੋਈ ਮਤਲਬ ਪੜ੍ਹ ਕੇ ਤੁਹਾਡੇ ਮਨ ਨੂੰ ਨਾ ਸੰਤੁਸ਼ਟੀ ਜਿਹੀ ਨਹੀਂ ਹੁੰਦੀ ਤਾਂ ਅਜਿਹੀਆਂ ਕਿਤਾਬਾਂ ਨੇ ਜਿਹੜੀਆਂ ਉਹ ਆਪਣੇ ਸਮਾਜ ਨੂੰ ਇੱਕ ਵਧੀਆ ਸੇਧ ਨਹੀਂ ਦੇ ਸਕਦੀਆਂ ਵਧੀਆ ਗੁਣਵੰਤਾ ਜਿਹੜੀ ਇਨਸਾਨਾਂ 'ਚ ਪੈਦਾ ਨਹੀਂ ਕਰ ਸਕਦੀਆਂ ਤਾਂ ਉਹ ਕਿਤਾਬਾਂ ਜਿਹੜੀਆਂ ਬਸ ਇੱਕ ਆਪਾਂ ਆਪਣਾ ਨਾਮਨਾ ਖੱਟਣ ਵਾਸਤੇ ਜਾਂ ਇੱਧਰੋਂ ਉੱਧਰੋਂ ਦੋ ਲਾਈਨਾਂ ਉੱਧਰੋਂ ਲੈ ਲਈਆਂ ਦੋ ਉੱਧਰੋਂ ਲੈ ਲਈਆਂ ਹੈ ਨਾ ਅਤੇ ਇੱਕ ਕਿਤਾਬ ਲਿਖਤੀ ਉਹ ਕਿਤਾਬਾਂ ਫਿਰ ਇਸ ਤੁੱਕ ਨੂੰ ਸਹੀ ਸਾਬਿਤ ਨਹੀਂ ਕਰਦੀਆਂ ਵੀ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੁੰਦੀਆਂ ਨੇ ਅਤੇ ਕਿਉਂਕਿ ਕਿਤਾਬ ਹੈ ਜਿਹੜੀ ਉਹ ਇੱਕ ਲਾਈਬਰੇਰੀ ਦੀ ਤਰ੍ਹਾਂ ਕੰਮ ਕਰਦੀ ਹੈ ਹੈ ਨਾ ਜਦੋਂ ਮਨੁੱਖ ਉਸ ਨੂੰ ਪੜ੍ਹਦਾ ਉਹਦੇ ਖਿਆਲ ਨੇ ਜਿਹੜੇ ਉਹ ਆਜ਼ਾਦ ਹੁੰਦੇ ਨੇ ਹੈ ਨਾ ਖੁੱਲ੍ਹੇ ਖੁੱਲ੍ਹੇ ਖਿਆਲ ਉਹਦੇ ਅੰਦਰ ਪੈਦਾ ਹੁੰਦੇ ਨੇ ਸਮਾਜ ਨੂੰ ਸਮਝਣ ਦੀ ਉਹ ਕੋਸ਼ਿਸ਼ ਕਰਦਾ ਤਾਂ ਅਜਿਹੀਆਂ ਕਿਤਾਬਾਂ ਨੇ ਜਿਹੜੀਆਂ ਉਹ ਮਨੁੱਖ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰ ਦਿੰਦੀਆਂ ਨੇ ਤਾਂ ਅਜਿਹੀਆਂ ਕਿਤਾਬਾਂ ਮੈਨੂੰ ਐਂ ਲੱਗਦਾ ਵੀ ਸ਼ਾਇਦ ਇਹ ਘੱਟ ਨਹੀਂ ਜ਼ਿਆਦਾ ਹੋਣੀਆਂ ਚਾਹੀਦੀਆਂ ਜਿਹੜੀਆਂ ਚੰਗੀਆਂ ਕਿਤਾਬਾਂ ਨੇ ਉਹੀ ਸਮਾਜ ਵਿੱਚ ਵਿਚਰਨੀਆਂ ਚਾਹੀਦੀਆਂ ਨੇ ਉਹੀ ਲੋਕਾਂ ਦੇ ਹੱਥਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਨੂੰ ਇੱਕ ਚੰਗੀ ਸੇਧ ਮਿਲ ਸਕੇ ਧੰਨਵਾਦ